ਜ਼ਿਆਦਾਤਰ ਮੈਂ ਆਪਣੇ ਕੱਪੜੇ ਵੋਸ਼ਿੰਗ ਮਸ਼ੀਨ ਰਾਹੀਂ ਧੋਂਦੀ ਹਾਂ ਜਿਸ ਲਈ ਮੈਨੂੰ ਪਹਿਲਾਂ ਟੱਪ 'ਚ ਪਾਣੀ ਭਰਨਾ ਪੈਂਦਾ ਹੈ ਟੂਟੀ ਰਾਹੀਂ ਅਤੇ ਫੇਰ ਜਦੋਂ ਟੱਪ 'ਚ ਪਾਣੀ ਭਰ ਹੋ ਜਾਂਦਾ ਹੈ ਉਸ ਤੋਂ ਬਾਅਦ ਮੈਂ ਉਸ ਪਾਣੀ ਨੂੰ ਚੱਕ ਕੇ ਮਸ਼ੀਨ 'ਚ ਪਾ ਦਿੰਦੀ ਹਾਂ ਮਸ਼ੀਨ 'ਚ ਜਦੋਂ ਮੇਰਾ ਪੂਰਾ ਪਾਣੀ ਭਰ ਜਾਂਦਾ ਹੈ ਤਾਂ ਮੈਂ ਉਸ ਵਿੱਚ ਸਰਫ਼ ਪਾ ਕੇ ਉਹਨੂੰ ਘੁਮਾ ਦਿੰਦੀ ਹਾਂ ਜਦੋਂ ਉਹ ਸਟਾਟ ਹੋ ਜਾਂਦੀ ਹੈ ਤਾਂ ਫੇਰ ਉਹ 'ਚ ਮੈਂ ਆਪਣੇ ਸਾਰੇ ਗੰਦੇ ਕੱਪੜੇ ਪਾ ਦਿੰਦੀ ਹਾਂ ਜਦੋਂ ਉਹ ਇੱਕ ਚੱਕਰ ਪੂਰਾ ਕਰ ਲੈਂਦੀ ਹੈ ਤਾਂ ਮੈਂ ਸਾਰੇ ਕੱਪੜੇ ਕੱਢ ਕੇ ਫਰਸ਼ 'ਤੇ ਸੁੱਟ ਸੁੱਟ ਲੈਂਦੀ ਹਾਂ ਫੇਰ ਟੱਪ 'ਚ ਇੱਕ ਇੱਕ ਟੱਬ 'ਚ ਪਾਣੀ ਪਾ ਕੇ ਉਸ 'ਚ ਉਹ ਕੱਪੜੇ ਦੋ ਵਾਰੀ ਕੱਢ ਕੇ ਉਹਨੂੰ ਸੁੱਕਣ ਲਈ ਮਸ਼ੀਨ 'ਚ ਪਾ ਕੇ ਪਾ ਦਿੰਦੀ ਹਾਂ ਫੇਰ ਮੈਂ ਉਨ੍ਹਾਂ ਕੱਪੜਿਆਂ ਨੂੰ ਲਿਜਾ ਕੇ ਛੱਤ 'ਤੇ ਸੁੱਕਣੇ ਪਾਉਣ ਪਾਉਂਦੀ ਹਾਂ ਜਿਸ ਵਿੱਚ ਮੈਂ ਕਈ ਕੱਪੜਿਆਂ ਨੂੰ ਬਨੇਰੇ 'ਤੇ ਪਾ ਦਿੰਦੀ ਹਾਂ ਕਈ ਕੱਪੜੇ ਮੈਂ ਉੱਪਰ ਛੱਤ 'ਤੇ ਇੱਕ ਤਾਰ ਬੰਨ੍ਹਿਆ ਹੋਇਆ ਉਹ 'ਤੇ ਸੁਕਾ ਦਿੰਦੀ ਹਾਂ ਕਈ ਕੱਪੜੇ ਮੈਂ ਨਿਚਲੇ ਬਨੇਰੇ 'ਤੇ ਵੀ ਪਾ ਦਿੰਦੀ ਹਾਂ ਇਸ ਤਰ੍ਹਾਂ ਮੈਂ ਵੱਖ ਵੱਖ ਥਾਵਾਂ 'ਤੇ ਆਪਣੇ ਕੱਪੜੇ ਸੁਕਾਉਂਦੀ ਹਾਂ ਜੇ ਨਹੀਂ ਤਾਂ ਕਈ ਵਾਰੀ ਮੈਂ ਆਪਣੇ ਕੱਪੜੇ ਹੱਥ ਰਾਹੀਂ ਵੀ ਧੋਂਦੀ ਹਾਂ ਜਿਸ ਲਈ ਮੈਂ ਕੱਪੜੇ ਕੱਪੜਿਆਂ ਨੂੰ ਸਾਬਣ ਨਾਲ ਧੋਂਦੀ ਹਾਂ ਕੱਪੜੇ ਧੋਣ ਵਾਲੇ ਜਿਸ ਵਿੱ ਜਿਸ ਲਈ ਮੈਂ ਟੱਪ 'ਚ ਪਾਣੀ ਪਾ ਕੇ ਕੱਪੜਿਆਂ ਨੂੰ ਗਿੱਲਾ ਕਰਦੀ ਹਾਂ ਗਿੱਲਾ ਕਰਨ ਤੋਂ ਬਾਅਦ ਕੱਪੜਿਆਂ 'ਤੇ ਸਾਬਣ ਲਾ ਲਾਉਂਦੀ ਹਾਂ ਸਾਬਣ ਲਾਉਣ ਤੋਂ ਬਾਅਦ ਮੈਂ ਉਨ੍ਹਾਂ ਕੱਪੜਿਆਂ ਮੈਂ ਉਨ੍ਹਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਬਰੱਸ਼ ਮਾਰ ਕੇ ਧੋਂਦੀ ਹਾਂ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਵਿੱਚੋਂ ਕੱਢ ਕੇ ਸਿੱਧਾ ਸੁੱਕਣੇ ਪਾ ਦਿੰਦੀ ਹਾਂ